ਭਾਰਤੀ ਅਰਥਚਾਰੇ ਦਾ ਜਿਹੜਾ ਵਿਕਾਸ ਹੈਗਾ ਪਹਿਲਾਂ ਦੇ ਸਾਲਾਂ ਨਾਲ਼ੋਂ ਹੁਣ ਬਹੁਤ ਵਧਿਆ ਗਾ ਭਾਰਤ ਤਰੱਕੀਆਂ ਕਰ ਰਿਹਾ ਗਾ ਲਗਾਤਾਰ ਮਤਲਬ ਇੱਥੇ ਕੋਈ ਨਾ ਕੋਈ ਨਵੀਂ ਇੰਡਸਟਰੀ ਆ ਜਿਹੜੀ ਖੁੱਲ੍ਹ ਰਹੀ ਹੈਗੀ ਜੇ ਇੰਟਰਨੈੱਟ ਬੈਂਕਿੰਗ ਜਾਂ ਡਿਜੀਟਲ ਭੁਗਤਾਨ ਦੀ ਗੱਲ ਕਰੀਏ ਤਾਂ ਮੈਂ ਜੀਪੇਅ ਯੂਜ ਕਰਦੀ ਐਂਗੀ ਤਾਂ ਲਗਾਤਾਰ ਜਿਹੜਾ ਮਤਲਬ ਮੈਨੂੰ ਕੋਈ ਭੁਗਤਾਨ ਕਰਨਾ ਹੁੰਦਾ ਗਾ ਤਾਂ ਮੈਂ ਇਸ ਦੇ ਰਾਹੀਂ ਕਰਦੀ ਐਂਗੀ ਜਿਹਦੇ ਨਾਲ਼ ਮਤਲਬ ਮੈਨੂੰ ਕੋਈ ਲੋੜ ਨਹੀਂ ਪੈਂਦੀ ਹੈਗੀ ਮੈਨੂੰ ਕੈਸ਼ ਕੋਲ ਰੱਖਣ ਦੀ ਤਾਂ ਇਸ ਤਰੀਕੇ ਨਾਲ਼ ਮੈਂ ਜਿਹੜਾ ਆਪ ਦਾ ਭੁਗਤਾਨ ਕਰ ਦਿੰਦੀ ਹਾਂ